ਪਿੰਡਾਂ ਵਿੱਚ ਖੇਡਣਾ ਖੇਡਣ ਨਾਲ ਵਿਅਕਤੀ ਆਪਸ ਵਿੱਚ ਪਿਆ ਆਪਸ ਵਿੱਚ ਪਿਆਰ ਵੱਧਦਾ ਹੈ ਸਤਿਕਾਰ ਕਰਦਾ ਹੈ ਪਿੰਡਾਂ ਵਿੱਚ ਵਿਅਕਤੀ ਇੱਕ ਦੂਜੇ ਖੇਡਾਂ ਵਿੱਚ ਪੈ ਕੇ ਨਸ਼ਿਆਂ ਤੋਂ ਦੂਰ ਰਹਿੰਦਾ ਹੈ ਅਤੇ ਆਹ ਇੱਕ ਦੂਜੇ ਦਾ ਸਤਿਕਾਰ ਕਰਦਾ ਹੈ ਕਿਤੇ ਵੀ ਚੀ ਜਾਂਦੇ ਹੋ ਤੁਸੀਂ ਕਰਦੇ ਹੋ ਨਸ਼ਿਆਂ ਤੋਂ ਦੂਰ ਰਹਿੰਦੇ ਆ ਅਤੇ ਆਪਣੀ ਸਿਹਤ ਦਾ ਪੂਰਾ ਖਿਆਲ ਰੱਖਦਾ ਹੈ ਖੇਡਾਂ ਵਿੱਚ ਹਰ ਇਕ ਚੀਜ ਚੀਜ਼ ਵਧੀਆ ਰਹਿੰਦੀ ਹੈ ਜੇਕਰ ਵਿਅਕਤੀ ਖੇਡਾਂ ਵਿੱਚ ਪੈ ਜਾਵੇ ਉਹ ਹਰ ਇੱਕ ਚੀਜ਼ ਤੋਂ ਦੂਰ ਰਹਿ ਸਕਦਾ ਹੈ ਉਹ ਖੇਡਾਂ ਨਾਲ ਵਿਦਿਆਰਥੀ ਮਾੜੀ ਸੰਗਤ ਤੋਂ ਦੂਰ ਰਹਿੰਦਾ ਹੈ ਜੇ ਕੋਈ ਉਹਨੂੰ ਮਾੜੀ ਸੰਗਤ ਤੋਂ ਦੂਰ ਪਾਊਗਾ ਤਾਂ ਉਹਦੀਆਂ ਖੇਡਾਂ ਉਸਨੂੰ ਬਚਾ ਬਚਾਉਂਦੀਆਂ ਅਤੇ ਉਹ ਖੇਡਾਂ ਖੇਡ ਕੇ ਹੀ ਇਕ ਦੂਜੇ ਦੇ ਨਾਲ ਪਿਆਰ ਵਧਾਉਂਦੀ ਆ ਹੁਨਰ ਜ਼ਿਆਦਾ ਪੈਦਾ ਕਰਦੀਆਂ ਕਿ ਬੰਦੇ ਮਤਲਬ ਦੂਰ ਰਹੇ ਨਸ਼ਿਆਂ ਤੋਂ ਦੂਰ ਰਹੇ ਦਾਰੂ ਸਿਗਰਟ ਤੰਬਾਕੂ ਜੋ ਵੀ ਕੁਛ ਇੰਨੇ ਨਸ਼ੇ ਹੁੰਦੇ ਹਨ ਉਹਨਾਂ ਤੋਂ ਦੂਰ ਰਹਿੰਦੇ ਚਿੱਟੇ ਤੋਂ ਜੇਕਰ ਜਵਾਕ ਕੋਈ ਵੀ ਵਿਅਕ ਵਿਅਕਤੀ ਖੇਡਾਂ ਨਾਲ ਖੇਡਦਾ ਹੈ ਮਤਲਵ ਨਸ਼ਾ ਕਰਕੇ ਖੇਡਦੇ ਤਾਂ ਉਸਦੇ ਪੈਰ ਠੰਡੇ ਰਹਿੰਦੇ ਗਰਮ ਜਦੋਂ ਬੰਦਾ ਖੇਡ ਪ੍ਰਤੀ ਖੇਡਦਾ ਹੈ ਤਾਂ ਉਸਦੇ ਪੈਰ ਗਰਮ ਹੁੰਦੇ ਆ ਜਿਹੜਾ ਨਸ਼ੇ ਕਰਦਾ ਉਸਦੇ ਪੈਰ ਠੰਡੇ ਹੁੰਦੇ ਆ ਇਸ ਲਈ ਵਿਅ ਵਿਅਕਤੀ ਜ਼ਿਆਦਾ ਤੋਂ ਜ਼ਿਆਦਾ ਖੇਡਾਂ ਵਿੱਚ ਇਸ ਲਈ ਭਾਗ ਲੈਂਦਾ ਕਿ ਉਹ ਨਸ਼ਿਆ ਤੋਂ ਦੂਰ ਰਹਿਣ ਅਤੇ ਉਹ ਆਪਣੀ ਆਪਣੇ ਪਿੰਡ ਦਾ ਨਾਮ ਉੱਚਾ ਕਰਨ ਅਤੇ ਵਧੀਆ ਆਪਣੀ ਸਿਹਤ ਬਚਾਉਣ ਕੇ ਨਸ਼ੇ ਵਾਲੇ ਵਿੱਚ ਛੇਤੀ ਮਰ ਜਾਂਦੇ ਜਿਹੜੇ ਵੀ ਜਵਾਕ ਗੇਮ ਨੂੰ ਖੇਡਾਂ 'ਚ ਭਾਗ ਲੈਂਦੇ ਆ ਤਾਂ ਉਹ ਉਹ ਵਧੀਆ ਆਪਣੀ ਜ਼ਿੰਦਗੀ ਬਤੀਤ ਕਰਦੇ ਆ ਅਤੇ ਨਾ ਹੀ ਉਹਨਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਨਾ ਕੋਈ ਉਹਨਾਂ ਨੂੰ ਬਿਮਾਰੀ ਲੱਗਿਆ ਜੇ ਆਪਣੇ ਉਹ ਖਾਣਾ ਪੀਣਾ ਵੀ ਸਹੀ ਖਾਣ ਉਹ ਵਧੀਆ ਹੀ ਰਹਿ